ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਿਲਕੁਲ ਮੈਂ ਉਸਦਾ ਮੈਨੇਜਰ ਰਵੀ ਗੱਲ ਕਰ ਰਿਹਾਂ ਮੈਂ ਤੁਹਾਡੀ ਕਿਸ ਪ੍ਰਕਾਰ ਸਹਾਇਤਾ ਕਰ ਸਕਦਾ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਪਲੱਸ ਟੂ ਕੀਤੀ ਹੋਈ ਹੈ ਤੁਸੀਂ ਉਹਦੇ ਬਿਹਾਫ 'ਤੇ ਜਾਣਾ ਹੈ ਅਤੇ ਤੁਹਾਨੂੰ ਮਿਨੀਮਮ ਤੁਹਾਨੂੰ ਸਿਕਸ ਪੁਆਇੰਟ ਸਿਕਸ ਮਤਲਬ ਬੈਂਡ ਚਾਹੀਦੇ ਨੇ ਬਾਕੀ ਤੁਸੀਂ ਇੱਦਾਂ ਕਰਿਉ ਮੈਂ ਤੁਹਾਨੂੰ ਜਿੰਨੀ ਵੀ ਪੂਰੀ ਫੁੱਲ ਡਿਟੇਲ ਹੈ ਤੁਸੀਂ ਇੱਕ ਵਾਰ ਔਫ਼ਿਸ ਵਿਜ਼ਿਟ ਕਰ ਲਿਉ ਤੁਹਾਨੂੰ ਉੱਥੇ ਔਫ਼ਿਸ ਵਿਜ਼ਿਟ ਕਰਨ ਕਰਨ ਤੋਂ ਬਾਅਦ ਜੋ ਵੀ ਹੈ ਹਾਫ਼ ਨੋਲੇਜ ਤੁਹਾਨੂੰ ਫੁੱਲ ਨੋਲੇਜ ਦਿੱਤੀ ਜਾਵੇਗੀ ਹਾਂਜੀ ਬਿਲਕੁਲ ਨਾਈਨ ਟੂ ਫਾਈਵ ਪੀ ਐੱਮ ਤੱਕ ਮੈਂ ਔਫ਼ਿਸ ਹੀ ਹੁੰਦਾ ਵੈਲਕਮ